ਹਾਂਜੀ ਵੈਲਕਮ ਮੈਮ ਹਾਂਜੀ ਹਾਂਜੀ ਦੱਸੋ ਮੈਮ ਕਿਆ ਦੇਖੋਗੇ ਹਾਂਜੀ ਮੈਮ ਕਿਹਨਾਂ ਲਈ ਦੇਖਣੇ ਹੈ ਤੁਸੀਂ ਖੁਦ ਲਈ ਦੇਖਣੇ ਹੈ ਓਕੇ ਕਿਸ ਤਰ੍ਹਾਂ ਦੇ ਲਉਗੇ ਮੈਮ ਓਕੇ ਸਕੈਚਰ ਦੇਖੋਗੇ ਮੈਮ ਸਕੈਚਰ ਪਿਊਮਾ ਐਡੀਡਾਸ ਕਿਹੜੇ ਲਉਗੇ ਐਡੀਡਸ ਦੇ ਓਕੇ ਮੈਮ ਮੈਮ ਕਲਰ ਕਲਰ ਚੋਇਸ ਓਕੇ ਮੈਮ ਬਲੈਕ 'ਚ ਗਰਲਿਸ਼ ਬਲੈਕ 'ਚ ਲੈ ਲਉ ਤੁਸੀਂ ਕੋਈ ਪਿੰਕ ਕਲਰ ਦੇਖ ਲਉ ਬੱਚਿਆਂ ਲਈ ਉਹ ਜ਼ਿਆਦਾ ਵਧੀਆ ਨਹੀਂ ਓਕੇ ਮੈਮ ਮੈਮ ਸਾਈਜ਼ ਓਕੇ ਮੈਮ ਮੈਮ ਆਹ ਵਾਲੇ ਦੇਖੋ ਆਹ ਸਹੀ ਆ ਮੈਮ ਓਕੇ ਮੈਮ ਇਹ ਦੇਖ ਲਉ ਅਲਾਈਟ ਪਿੰਕ ਕਲਰ 'ਚ ਹੈ ਓਕੇ ਓਕੇ ਆਹ ਦੇਖੋ ਮੈਮ ਆਹ ਆਹ ਵਾਲੇ ਨਿਊ ਆ ਬਿਲਕੁਲ ਨਵੇਂ ਟਰੈਂਡ 'ਚ ਆਏ ਆ ਆਹ ਵਾਇਟ ਮੈਮ ਇਹ ਸਿਕਸ ਥਾਊਸੈਂਡ ਇਹ 'ਚ ਟੈੱਨ ਪਰਸੈਂਟ ਤੁਹਾਨੂੰ ਡਿਸਕਾਊਂਟ ਮਿਲ ਜਾਵੇਗਾ ਹਾਂਜੀ ਇਹ ਫਿਫਟੀ ਸਿਕਸ ਹੰਡਰਡ ਦਾ ਫਿਫਟੀ ਫੋਰ ਹੰਡਰਡ ਦੇ ਪੈ ਜਾਣਗੇ ਹਾਂ ਮੈਮ ਇਹ ਇਹੀ ਆਰਟੀਕਲ ਚਾਹੀਦੇ ਆ ਇਹਦੇ 'ਚ ਕਲਰ ਚਾਹੀਦਾ ਜਾਂ ਕੋਈ ਹੋਰ ਚਾਹੀਦਾ ਮੋਡਲ ਚੇਂਜ ਕਰ ਦੇਈਏ

ਮੈਮ ਫਿਰ ਤੁਸੀਂ ਬਾਟਾ 'ਚ ਦੇਖ ਲਉ ਬਾਟਾ 'ਚ ਫਿਫਟੀ ਪਰਸੈਂਟ ਔਫ ਚੱਲ ਰਹੀ ਹੈ ਤੁਸੀਂ ਬਾਟਾ ਦੇਖ ਲਉ ਹਾਂਜੀ ਮੈਮ ਆਹ ਦੇਖ ਲਉ ਇਹ ਬਾਟਾ ਵਿੱਚ ਇਹ ਵਾਲੇ ਆਰਟੀਕਲ ਅਵੇਲੇਬਲ ਹੈ ਇਸ 'ਚ ਫਿਫਟੀ ਪਰਸੈਂਟ ਔਫ ਲੱਗੀ ਹੋਈ ਹੈ ਇਸ 'ਚ ਤੁਹਾਡਾ ਸਾਈਜ਼ ਵੀ ਅਵੇਲੇਬਲ ਹੈ ਇਹਦਾ ਮੈਮ ਬਾਰਾਂ ਸੌ ਰੁਪਏ ਪ੍ਰਾਈਸ ਆ ਆਫਟਰ ਡਿਸਕਾਊਂਟ ਮੈਮ ਆਫਟਰ ਡਿਸਕਾਊਂਟ ਬਾਰਾਂ ਸੌ ਉਸ ਤਰ੍ਹਾਂ ਚੌਵੀ ਸੌ ਹੈ ਫਿਫਟੀ ਪਰਸੈਂਟ ਡਿਸਕਾਊਂਟ ਤੋਂ ਬਾਅਦ ਬਾਰਾਂ ਸੌ ਰੁਪਏ ਨਹੀਂ ਮੈਮ ਜਿੰਨਾ ਕੰਪਨੀ ਵੱਲੋਂ ਡਿਸਕਾਊਂਟ ਆਉਂਦਾ ਆਪਾਂ ਓਨਾ ਹੀ ਦੇ ਸਕਦੇ ਹਾਂ ਮੈਮ ਬਾਰਾਂ ਸੌ ਹੀ ਡਿਸਕਾਊਂਟ ਮਿਲੇਗਾ ਤੁਹਾਨੂੰ ਬਾਰਾਂ ਸੌ ਦੀ ਹੀ ਮਿਲੇਗੀ ਬਾਰਾਂ ਸੌ ਡਿਸਕਾਊਂਟ ਮਿਲੇਗੀ ਓਕੇ ਥੈਂਕ ਯੂ ਮੈਮ ਓਕੇ ਡਨ ਥੈ